ਸਾਨੂੰ ਗਰਮੀਆਂ ਵਿੱਚ ਦੌੜਨ ਲਈ ਖੁੱਲ੍ਹੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸਾਨੂੰ ਦੌੜਾਂ ਲਗਾਉਣ ਵੇਲੇ ਹੈ ਨਾ ਪਾਣੀ ਦੀ ਬੋਟਲ ਕੋਲ਼ ਰੱਖਣੀ ਚਾਹੀਦੀ ਹੈ ਔਰ ਭੱਜਣ ਤੋਂ ਇਕਦਮ ਬਾਅਦ ਇਹ ਸਾਨੂੰ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਅਗਰ ਆਪਾਂ ਅਸੀਂ ਇਕਦਮ ਪਾਣੀ ਪੀਂਦੇ ਹਾਂ ਅਤੇ ਸਾਡੀ ਬੌਡੀ ਨੂੰ ਉਹ ਗਰਮ ਸਰਦ ਕਰ ਦਿੰਦਾ ਹੈ ਜਿਸ ਨਾਲ਼ ਕਿ ਅਸੀਂ ਬਿਮਾਰ ਵੀ ਪੈ ਸਕਦੇ ਹਾਂ ਅਤੇ ਇਸ ਕਰਕੇ ਸਾਨੂੰ ਪਾਣੀ ਇਕਦਮ ਪਾਣੀ ਨਹੀਂ ਪੀਣਾ ਚਾਹੀਦਾ ਇਕਦਮ ਪਾਣੀ ਨਹੀਂ ਪੀਣਾ ਚਾਹੀਦਾ ਅਤੇ ਠੰਡ ਵਿੱਚ ਸਾਨੂੰ ਕੱਪੜੇ ਪੂਰੇ ਪਹਿਨਣੇ ਚਾਹੀਦੇ ਹਨ ਅਤੇ ਸਾਨੂੰ ਠੰਡਾਂ ਵਿੱਚ ਇਕਦਮ ਗਰਮੀ ਆਉਣ 'ਤੇ ਸਾਨੂੰ ਕੱਪੜੇ ਨਹੀਂ ਖੋਲ੍ਹਣੇ ਚਾਹੀਦੇ ਤਾਂ ਕਿ ਤਾਂ ਕਿ ਤਾਂ ਕਿ ਸਾਡਾ ਸਰੀਰ ਗਰਮ ਸਰਦ ਨਾ ਹੋਵੇ ਅਤੇ ਬਰਸਾਤ ਵਿੱਚ ਦੌੜਨ ਲਈ ਸਾਨੂੰ ਕਿਸੇ ਕਵਰ ਏਰੀਆ 'ਚ ਕਿਸੇ ਪਲੇਅਗਰਾਊਂਡ 'ਚ ਹੀ ਦੌੜਨਾ ਚਾਹੀਦਾ ਹੈ ਅਤੇ ਖੁੱਲ੍ਹੇ ਕੱਪੜੇ ਪਹਿਨਣੇ ਚਾਹੀਦੇ ਹਨ ਪੂਰੇ ਕੱਪੜੇ ਪਹਿਨਣੇ ਚਾਹੀਦੇ ਹਨ ਤਾਂ ਜੋ ਸਾਨੂੰ ਕਿਸੇ ਵੀ ਤਰ੍ਹਾਂ ਦੀ ਹਾਨੀਕਾਰਕ ਸਮੱਸਿਆ ਨਾ ਆਵੇ